ਮੈਂ ਖਾਣ ਪੀਣ ਦੀ ਬਹੁਤ ਸ਼ੌਕੀਨ ਹਾਂ ਮੈਨੂੰ ਖਾਣ ਪੀਣ ਦੇ ਵਿੱਚ ਜਦੋਂ ਮੈਂ ਕਿਤੇ ਬਾਹਰ ਜਾਦੀ ਹਾਂ ਜਾਂ ਘਰ ਦੇ ਵਿੱਚ ਮੈਨੂੰ ਸਪੰਜੀ ਰਸਗੁੱਲਾ ਅਤੇ ਡੋਕਲਾ ਬਹੁਤ ਹੀ ਪਸੰਦ ਨੇ ਮੈਨੂੰ ਉਹਨਾਂ ਨੂੰ ਖਾਣ ਤੋਂ ਬਾਅਦ ਇੱਕ ਆਨੰਦ ਜਿਹਾ ਮਹਿਸੂਸ ਹੁੰਦਾ ਹੈ ਜਦ ਵੀ ਮੈਨੂੰ ਔਫਿਸ ਦੇ ਵਿੱਚ ਕੋਈ ਖਾਣ ਲਈ ਪੁੱਛਦਾ ਹੈ ਤਾਂ ਮੈਂ ਉਹਨਾਂ ਨੂੰ ਇਹੀ ਕਹਿੰਦੀ ਹਾਂ ਕਿ ਮੈਨੂੰ ਸਪੰਜੀ ਰਸਗੁੱਲਾ ਲੈ ਕੇ ਆਇਓ ਮੇਰੇ ਲਈ ਅਤੇ ਜਿਸ ਦਿਨ ਛੁੱਟੀ ਹੁੰਦੀ ਹੈ ਘਰ ਦੇ ਵਿੱਚ ਵੀ ਮੈਂ ਆਪਣਾ ਆਪ ਸਪੰਜੀ ਰਸਗੁੱਲਾ ਅਤੇ ਡੋਕਲਾ ਬਣਾ ਕੇ ਆਪਣੇ ਬੱਚਿਆਂ ਨਾਲ ਬੈਠ ਕੇ ਖਾਂਦੀ ਹਾਂ ਜਦ ਮੈਂ ਕਿਤੇ ਬਾਹਰ ਜਾਂਦੀ ਹਾਂ ਤਾਂ ਮੈਂ ਸਪੰਜੀ ਰਸਗੁੱਲਾ ਜਾਂ ਡੋਕਲਾ ਔਡਰ ਕਰਨਾ ਜਾਂ ਖਾਣਾ ਹੀ ਪਸੰਦ ਕਰਦੀ ਹਾਂ ਇਸ ਨੂੰ ਖਾ ਖਾਣਾ ਇੱਕ ਮੇਰਾ ਬਚਪਨ ਤੋਂ ਹੀ ਸ਼ੌਕ ਹੈ ਅਤੇ ਮੈਨੂੰ ਬਹੁਤ ਹੀ ਟੇਸਟੀ ਲੱਗਦਾ ਹੈ ਜੇ ਔਡਰ ਵੀ ਰੂਟੀਨ ਦੇ ਵਿੱਚ ਮੈਂ ਹਫਤੇ ਦੇ ਵਿੱਚ ਦੋ ਤਿੰਨ ਵਾਰੀ ਇਸ ਨੂੰ ਕਰ ਦਿੰਦੀ ਹਾਂ ਥੈਂਕ ਯੂ